ਬਾਈਕਿੰਗ ਚਲਾਉਣ ਸਮੇਂ ਗੇਅਰ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਜੋ ਕਿ ਇਸ ਦੇ ਨਾਲ ਸਾਜੋ ਸਮਾਨ ਦੇ ਬਹੁਤ ਮਹੱਤਵਪੂਰਨ ਟੁਕੜੇ ਹਨ ਤੁਸੀਂ ਮੈਂ ਹਮੇਸ਼ਾ ਆਪਣੇ ਨਾਲ ਇਸਦੀ ਟੂਲ ਕਿੱਟ ਵੀ ਰੱਖਦਾ ਇਸ ਟੂਲ ਕਿੱਟ ਵੀ ਰੱਖਦਾ ਹਾਂ ਤਾਂ ਜੋ ਕੋਈ ਥੋੜ੍ਹੀ ਮੋਟੀ ਪਰੇਸ਼ਾਨੀ ਆਵੇ ਤਾਂ ਮੈਂ ਦੇਖ ਸਕਾਂ ਗੇਅਰ ਇਸਦੇ ਗੇਅਰ ਬਾਈਕ ਦੇ ਇਕੱਠੇ ਦੋ ਦੋ ਨਹੀਂ ਪਾਉਣੇ ਚਾਹੀਦੇ ਪਹਿਲੇ ਗੇਅਰ ਤੋਂ ਹੀ ਇਸਨੂੰ ਸਟਾ ਲੈ ਕੇ ਜਾਣਾ ਚਾਹੀਦਾ ਹੌਲੀ ਹੌਲੀ ਗੇਅਰ ਬਦਲਣੇ ਚਾਹੀਦੇ ਹਨ ਜਦੋਂ ਗੱਡੀ ਰੇਂਜ ਵਿੱਚ ਆ ਜਾਵੇ ਤਾਂ ਉਦੋਂ ਆਰਾਮ ਨਾਲ ਦੂਜਾ ਤੀਜਾ ਗੇਅਰ ਪਾਉਣਾ ਚਾਹੀਦਾ ਹੈ ਤਾਂ ਕਿ ਜੋ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਆਪਣੇ ਸਾਰਾ ਸਮਾਨ ਮੈਂ ਟੂਲ ਕਿੱਟ ਆਪਣੇ ਪੇਪਰ ਪ੍ਰਦੂਸ਼ਣ ਸਭ ਕੁਛ ਨਾਲ ਰੱਖਦਾ ਹਾਂ ਤਾਂ ਕਿ ਜੋ ਰਸਤੇ ਵਿੱਚ ਮੈਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਿਰ ਵੀ ਜੇ ਕਿਤੇ ਰਸਤੇ ਵਿੱਚ ਬਾਈਕ ਮੇਰੀ ਖ਼ਰਾਬ ਹੋ ਜਾਵੇ ਤਾਂ ਮੈਂ ਟੂਲ ਕਿੱਟ ਨਾਲ ਕੋਸ਼ਿਸ਼ ਕਰਦਾ ਹਾਂ ਠੀਕ ਕਰਨ ਦੀ ਜੇ ਨਾ ਹੋਵੇ ਫਿਰ ਫਿਰ ਮੈਂ ਗੂਗਲ ਮੈਪ ਤੋਂ ਦੇਖਦਾ ਹਾਂ ਲੋਕਲ ਮਕੈਨਿਕ ਕੋਲ ਕੋਲ ਕੌਣ ਹੈ ਕੀਹਦੀ ਸ਼ੋਪ ਹੈ ਫਿਰ ਮੈਂ ਉਸਨੂੰ ਕੋਲ ਕਰਕੇ ਬੁਲਾਉਂਦਾ ਹਾਂ ਕਿ ਇੱਦਾਂ ਬਾਈਕ ਮੇਰੀ ਖ਼ਰਾਬ ਹੋ ਗਈ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਕਹਿੰਦੇ ਹਾਂਜੀ ਆਪਾਂ ਆ ਕੇ ਥੋੜ੍ਹੀ ਦੇਰ ਦੇ ਵਿੱਚ ਦੇਖ ਲੈਂਦੇ ਹਾਂ ਤੁਸੀਂ ਆਪਣੀ ਲੋਕੇਸ਼ਨ ਸੈਂਡ ਕਰ ਦੇਵੋ ਸਾਈਕਲ ਆਪਣੀ ਲਾਈਫ ਵਿੱਚ ਮੈਂ ਸਾਈਕਲ ਦਾ ਸਫ਼ਰ ਕਦੇ ਨਹੀਂ ਕੀਤਾ ਇਸ ਲਈ ਮੈਨੂੰ ਸਾਈਕਲ ਦਾ ਕੋਈ ਅਨੁਭਵ ਨਹੀਂ ਹੈ ਮੈਂ ਬਾਈਕ ਨੂੰ ਹੀ ਆਰਾਮ ਨਾਲ ਚਲਾਉਂਦਾ ਹਾਂ ਅਤੇ ਉਸ ਦੀ ਟਾਈਮ ਸਿਰ ਸਰਵਿਸ ਕਰਵਾਉਂਦਾ ਹਾਂ ਕਿ ਤਾਂ ਕਿ ਜੋ ਮੈਨੂੰ ਕੋਈ ਵੀ ਰਸਤੇ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ